ਹੈਲੋ ਸਤਿ ਸ਼੍ਰੀ ਅਕਾਲ ਸਰ ਸਰ ਮੈਂ ਨਾ ਮੀਡੀਆ ਪਰਸਨ ਗੱਲ ਕਰਦੀ ਹਾਂ ਐਕਚੁਲੀ ਸਰ ਐਕਚੁਲੀ ਨਾ ਮੈਨੂੰ ਥੋੜ੍ਹੀ ਜਿਹੀ ਜਾਣਕਾਰੀ ਚਾਹੀਦੀ ਹੈ ਜੇ ਤੁਸੀਂ ਮੇਰੇ ਨਾਲ ਗੱਲ ਕਰਨ 'ਚ ਕੰਫਰਟੇਬਲ ਹੋ ਤਾਂ ਜੀ ਐਕਚੁਲੀ ਮੈਂ ਫੋਰੈਫਰੈਂਸ ਦੱਸਣਾ ਚਾਹੁੰਦੀ ਹਾਂ ਕਿ ਮੈਂ ਨਾ ਪੰਜਾਬ ਦੇ ਸਾਰੇ ਹੀ ਡਿਸਟਰਿਕਟ ਕਵਰ ਕਰ ਰਹੀ ਹਾਂ ਤਾਂ ਮੈਂ ਐਕਚੁਲੀ ਬਠਿੰਡੇ ਦੇ ਬਾਰੇ ਇਹ ਪੁੱਛਣਾ ਚਾਹੁੰਦੀ ਹਾਂ ਮੈਨੂੰ ਇਹ ਪਤਾ ਲੱਗਿਆ ਕਿ ਤੁਸੀਂ ਉੱਥੋਂ ਦੇ ਲੋਕਲ ਰਹਿਣ ਵਾਲੇ ਹੋ ਹਾਂਜੀ ਅਤੇ ਸਰ ਐਕਚੁਲੀ ਮੇਰਾ ਟੋਪਿਕ ਇਹ ਹੈਗਾ ਕਿ ਤੁਸੀਂ ਮੈਨੂੰ ਉੱਥੋਂ ਦੀ ਕੁਛ ਜਿਹੜੀ ਨਾਊਨ ਪਰਸਨੈਲਿਟੀਸ ਬਾਰੇ ਦੱਸ ਸਕਦੇ ਹੋ ਬਠਿੰਡੇ ਦੀਆਂ

ਠੀਕ ਹੈ ਸਰ ਠੀਕ ਹੈ ਸਰ ਸਰ ਐਕਚੁਲੀ ਮੈਂ ਬਠਿੰਡਾ ਕਵਰ ਕਰ ਰਹੀ ਹਾਂ ਓਕੇ ਜੀ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਜੀ ਹਾਂਜੀ ਹਾਂਜੀ ਸਰ ਉਹਨਾਂ ਬਾਰੇ ਤਾਂ ਬਹੁਤ ਸੁਣਿਆ ਜੀ ਜੀ ਜੀ ਜੀ ਜੀ ਸਰ ਐਕਚੁਲੀ ਮਤਲਬ ਤੁਸੀਂ ਇਹਨਾਂ ਬਾਰੇ ਥੋੜ੍ਹਾ ਹੋਰ ਡਿਟੇਲ 'ਚ ਦੱਸ ਸਕਦੇ ਹੋ ਡੋਕਟਰ ਵੀਨੇ ਦੇ ਰਿਗਾਰਡਿੰਗ ਜੀ ਹਾਂਜੀ ਓਕੇ ਮਤਲਬ ਉਹਨਾਂ ਨੇ ਆਪਣੀ ਅਕੈਡਮੀਕ ਵਗੈਰਾ ਓਕੇ ਠੀਕ ਹੈ ਠੀਕ ਹੈ ਠੀਕ ਹੈ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਅਤੇ ਜੇ ਮੈਨੂੰ ਇਸ ਤੋਂ ਇਲਾਵਾ ਕੋਈ ਹਾਂਜੀ ਜੇ ਸਰ ਮੈਨੂੰ ਇਸ ਤੋਂ ਇਲਾਵਾ ਕੋਈ ਹੋਰ ਇਹਨਾਂ ਦੇ ਰਿਗਾਰਡਿੰਗ ਕੁਛ ਵੀ ਮਤਲਬ ਇਨਫੋਰਮੇਸ਼ਨ ਚਾਹੀਦੀ ਹੋਈ ਤਾਂ ਮੈਂ ਜ਼ਰੂਰ ਤੁਹਾਨੂੰ ਦੁਬਾਰਾ ਪੁੱਛਾਂਗੀ ਠੀਕ ਹੈ ਸਰ ਜੀ ਜੀ ਜੀ ਬਹੁਤ ਬਹੁਤ ਧੰਨਵਾਦ ਸਰ ਓਕੇ ਓਕੇ ਓਕੇ ਜੀ ਓਕੇ ਜੀ